ਨਿਊਜ਼ ਪੰਜਾਬ ਵਿੱਚ ਨਿਊਜ਼ ਚੈਨਲ ਜਿਹੜੇ ਹੈਗੇ ਹੈ ਉਹ ਐਨੇ ਵੀ ਸੰਵੇਦਨਸ਼ੀਲ ਨਹੀਂ ਹੈ ਹਰ ਇੱਕ ਆਪਣੀ ਆਪਣੀ ਹਰ ਨਿਊਜ਼ ਵੀ ਨਿਊਜ਼ ਚੈਨਲ ਵਿੱਚ ਆਪਣੀ ਆਪਣੀ ਹੀ ਕੀਤੀ ਜਾਂਦੀ ਹੈ ਧਰਮ ਦੇ ਖਿਲਾਫ਼ ਬਹੁਤ ਜ਼ਿਆਦਾ ਆਪਸ 'ਚ ਉਹਨਾਂ ਦੇ ਮਤਭੇਦ ਹੋਏ ਕਰਦੇ ਹੈ ਇਲੈਕਸ਼ਨ ਦੇਖੇ ਜਾਣ ਅਤੇ ਉਹਦੇ ਵਿੱਚ ਵੀ ਧਰਮ ਦੇ ਖਿਲਾਫ਼ ਬੜੇ ਮਤਭੇਦ ਹੋਇਆ ਕਰਦੇ ਹੈ ਬਲਕਿ ਕਿਹਾ ਜਾਇਆ ਕਰਦਾ ਕਿ ਜਿਸ ਤਰ੍ਹਾਂ ਰਾਮ ਮੰਦਿਰ ਬਣਿਆ ਹੈ ਉਸ ਤੋਂ ਬਾਅਦ ਇਲੈਕਸ਼ਨਾਂ ਦੇ ਚੇਂਜਿੰਗ ਕੀਤੀ ਗਈ ਹੈ ਕਿ ਇਲੈਕਸ਼ਨ ਕਿਸ ਤਰ੍ਹਾਂ ਹੋਣੇ ਹੈ ਕਿਸ ਤਰ੍ਹਾਂ ਨਹੀਂ ਹੋਣੇ ਆ ਹਰ ਇੱਕ ਨਿਊਜ਼ ਚੈਨਲ ਹਰ ਮਤਲਬ ਕਿ ਧਰਮ ਦੇ ਖਿਲਾਫ਼ ਹੀ ਖੜ੍ਹਾ ਹੈਗਾ ਹਰ ਕੋਈ ਵੀ ਚੈਨਲ ਤੁਸੀਂ ਲਾ ਕੇ ਦੇਖ ਲਓ ਹਰ ਇੱਕ ਨਿਊਜ਼ ਚੈਨਲ ਉੱਤੇ ਧਰਮ ਦੇ ਅਕੋਰਡਿੰਗ ਹੀ ਤੁਹਾਨੂੰ ਕੋਈ ਨਾ ਕੋਈ ਨਿਊਜ਼ ਮਿਲੇਗੀ ਕੋਈ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਹੈ ਹਰ ਧਰਮ ਵਾਲਾ ਦੂਸਰੇ ਧਰਮ ਦੀ ਬੇਇੱਜ਼ਤੀ ਕਰਨ ਨੂੰ ਤਿਆਰ ਬੈਠੇ ਦਾ ਅਤੇ ਇਸ ਕਰਕੇ ਨਿਊਜ਼ ਚੈਨਲ ਅਤੇ ਹਰ ਇੱਕ ਛੋਟੀ ਜਿਹੀ ਗੱਲ ਨੂੰ ਵੀ ਬਹੁਤ ਵਧਾ ਚੜ੍ਹਾ ਕੇ ਦੱਸਦੇ ਹੈ ਦੱਸਿਆ ਜਾਂਦਾ ਹੈ ਕਿ ਮਤਲਬ ਕਿ ਕਿਸ ਤਰ੍ਹਾਂ ਅਸੀਂ ਕਰਨਾ ਹੈਗਾ